ਬੈਂਕ ਦੇ ਲਾਭ ਹੋਣ ਦੇ ਨਾਲ ਨਾਲ ਕੁਝ ਮਾੜੇ ਅਨੁਭਵ ਵੀ ਹਨ ਬੈਂਕ ਨਾਲ ਨਜਿੱਠਣ ਵੇਲੇ ਸਾਨੂੰ ਬਹੁਤ ਹੀ ਗੁੱਝੀਆਂ ਚਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਕਿਸੇ ਟਾਈਮ ਸਟਾਫ ਹੀ ਚੰਗਾ ਨਹੀਂ ਹੁੰਦਾ ਬੈਂਕ ਦਾ ਮੈਨੇਜਰ ਹੋਰ ਸਟਾਫ ਬਹੁਤ ਹੀ ਗੁੱਸੇ ਵਾਲਾ ਹੁੰਦਾ ਹੈ ਜਿਸ ਕਾਰਨ ਸਾਨੂੰ ਉਹਨਾਂ ਦੀ ਬੋਲੀ ਦਾ ਸਾਹਮਣਾ ਕਰਨਾ ਪੈਂਦਾ ਹੈ ਬੈਂਕ ਵਿੱਚ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਹਨ ਭੀੜ ਭੜੱਕਾ ਹੋਣ ਕਾਰਨ ਸਾਡਾ ਕੋਈ ਵੀ ਕੰਮ ਜਲਦੀ ਨਹੀਂ ਨਿਬੜਦਾ ਥਾਂ ਥਾਂ 'ਤੇ ਸਾਨੂੰ ਪੇਪਰ ਲੈ ਕੇ ਭਟਕਣਾ ਪੈਂਦਾ ਹੈ ਔਨਲਾਈਨ ਸਿਸਟਮ ਹੋਣ ਦੇ ਕਾਰਨ ਵੀ ਸਾਨੂੰ ਪੇਪਰ ਥਾਂ ਥਾਂ ਤੋਂ ਸਾਈਨ ਕਰਵਾਉਣੇ ਪੈਂਦੇ ਹਨ ਕੋਈ ਇਹ ਸਾਈਨ ਕਰਦਾ ਹੈ ਜਾਂ ਕੋਈ ਨਹੀਂ ਕਰਦਾ ਸਾਨੂੰ ਇਸ ਬਾਰੇ ਬਹੁਤ ਖੱਜਲ ਖਵਾਰ ਹੋਣਾ ਪੈਂਦਾ ਹੈ ਬੈਂਕ ਦੇ ਲਾਭ ਹੋਣ ਦੇ ਨਾਲ ਨਾਲ ਮਾੜੇ ਅਤੇ ਗੁੱਝੇ ਅਨੁਭਵ ਵੀ ਹਨ